ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਸ਼ਾ ਰਾਣੀ ਹਾਂਜੀ ਹਾਂਜੀ ਬੋਲੀਏ ਹਾਂਜੀ ਹਾਂਜੀ ਹਾਂਜੀ ਫੇਮਸ ਪਲੇਸ ਇੱਥੇ ਵੈਸੇ ਤਾਂ ਬਹੁਤ ਜ਼ਿਆਦਾ ਵਧੀਆ ਸਾਰੇ ਹੈਗੇ ਹਾਂ ਅਤੇ ਹਾਂਜੀ ਅੰਮ੍ਰਿਤਸਰ ਹੋ ਗਿਆ ਜਿੱਦਾਂ ਤਖ਼ਤ ਸ਼੍ਰੀ ਕੇਸਗੜ੍ਹ ਹੋ ਗਿਆ ਅਨੰਦਪੁਰ ਸਾਹਿਬ ਹੋ ਗਿਆ ਇਹ ਫੇਮਸ ਪ੍ਰਸਿੱਧ ਹੈਗੇ ਆ ਨਾ ਹਾਂਜੀ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਅੰਮ੍ਰਿਤਸਰ ਬਹੁਤ ਹੀ ਪ੍ਰਸਿੱਧ ਧਾਰਮਿਕ ਸਥਾਨ ਹੈ ਵੈਸੇ ਹਾਂਜੀ ਅਤੇ ਵਧੀਆ ਆ ਰਹਿਣ ਸਹਿਣ ਬਹੁਤ ਹੀ ਵਧੀਆ ਹੈ ਰਹਿਣ ਸਹਿਣ ਹੋ ਗਿਆ ਜੇ ਤੁਸੀਂ ਕੋਈ ਰੈਸਟੋਰੈਂਟ ਲਵੋਗੇ ਰਹਿਣ ਲਈ ਲਵੋਗੇ ਜਗ੍ਹਾ ਲਵੋਗੇ ਖਾਣ ਪੀਣ ਲਈ ਤਾਂ ਸਾਰਾ ਪਰੋਪਰ ਵਧੀਆ ਮਿਲਦਾ ਹੈ ਹਾਂਜੀ ਰੈਂਟ 'ਤੇ ਜਿੱਦਾਂ ਮੰਨਕੇ ਚੱਲਦੇ ਹਾਂ ਉਹ ਹੀ ਤਕਰੀਬਨ ਪੰਦਰ੍ਹਾਂ ਸੌ ਤੱਕ ਮਿਲ ਜਾਊਗਾ ਤੋਹਾਨੂੰ ਹਾਂਜੀ ਜੇ ਤੁਸੀਂ ਲੈਣਾ ਚਾਹੋਗੇ ਹਾਂਜੀ ਉਹ ਹੀ ਪੰਦਰ੍ਹਾਂ ਸੌ ਦੋ ਹਜ਼ਾਰ ਤੱਕ ਤਕਰੀਬਨ ਰਹਿਣ ਸਹਿਣ ਵਿੱਚ ਰੈਂਟ ਲਈ ਰੂਮ ਹੋ ਜਾਣਾ ਹੈ ਅਤੇ ਰਹਿਣ ਸਹਿਣ ਲਈ ਸਾਰਾ ਖਾਣ ਪੀਣ ਲਈ ਵਿੱਚ ਹੋਣਾ ਤੋਹਾਡਾ ਸਾਰਾ ਹਨਾਂ ਹਾਂਜੀ ਵੈਸੇ ਬਹੁਤ ਵਧੀਆ ਹੈ ਅੰਮ੍ਰਿਤਸਰ ਹਾਂਜੀ ਠੀਕ ਠੀਕ ਹੈ ਓਕੇ ਓਕੇ